ਹਾਂਜੀ ਮੈਨੂੰ ਦੌੜਨਾ ਬਹੁਤ ਜ਼ਿਆਦਾ ਪਸੰਦ ਹੈ ਬਚਪਨ ਤੋਂ ਹੀ ਅਤੇ ਬਚਪਨ ਤੋਂ ਹੀ ਦੌੜਨ ਦੇ ਸੰਬੰਧੀ ਮੇਰੇ ਨਾਲ ਕੁਝ ਯਾਦਾਂ ਜੁੜੀਆਂ ਹੋਈਆਂ ਨੇ ਕਿਉਂਕਿ ਬਚਪਨ ਦੇ ਵਿੱਚ ਮੈਂ ਬਹੁਤ ਜ਼ਿਆਦਾ ਸ਼ਰਾਰਤਾਂ ਕਰਦਾ ਅਤੇ ਸ਼ਰਾਰਤ ਕਰਕੇ ਇਹੋ ਜਿਹਾ ਦੌੜਦਾ ਕਿ ਮੈਂ ਕਦੇ ਕਿਸੇ ਦੇ ਹੱਥ ਨਹੀਂ ਆਇਆ ਸੀਗਾ ਅਤੇ ਮੈਂ ਤੁਹਾਡੇ ਨਾਲ ਆਪਣੀ ਇੱਕ ਬਚਪਨ ਦੀ ਸ਼ਰਾਰਤ ਆ ਜਿਹੜੀ ਸਾਂਝੀ ਕਰਨੀ ਚਾਹੁੰਦਾ ਹੈਗਾ ਕਿ ਬਚਪਨ ਦੇ ਵਿੱਚ ਮੈਂ ਸੀਗਾ ਸੱਤ ਅੱਠ ਸਾਲ ਦਾ ਅਤੇ ਜਦੋਂ ਮੈਂ ਚਾਰ ਪੰਜ ਬੱਚੇ ਹੋਰ ਆਪਣੇ ਮਗਰ ਲਾ ਲਏ ਮੈਂ ਕਿਹਾ ਵੀ ਜਿਹੜਾ ਉਹ ਦੁਕਾਨਦਾਰ ਹੈ ਨਾ ਉਹ ਮੂੰਗੀ ਵੇਚ ਰਿਹਾ ਸੀ ਕਿਸੇ ਨੂੰ ਆਪਦੇ ਤੱਕੜੀ ਦੇ ਵਿੱਚ ਪਾ ਕੇ ਤਾਂ ਮੈਂ ਕੀ ਕੀਤਾ ਮੁੱਠੀ ਦੇ ਵਿੱਚ ਦੋਵਾਂ ਬੁੱਕਾਂ ਦੇ ਵਿੱਚ ਮੈਂ ਰੇਤੇ ਦੇ ਭਰ ਲਏ ਨਾਲ ਮੈਂ ਉਹ ਬੱਚੇ ਲਗਾ ਲਏ ਅਤੇ ਸਭ ਤੋਂ ਪਹਿਲਾ ਬੁੱਕ ਮੈਂ ਪਾਇਆ ਉਹਦੀ ਮੂੰਗੀ ਦੇ ਵਿੱਚ ਮੈਂ ਦੌੜ ਗਿਆ ਅਤੇ ਉਹਨਾਂ ਨੇ ਵੀ ਪਾਇਆ ਅਤੇ ਉਹ ਬੇਚਾਰੇ ਫੜੇ ਗਏ ਅਤੇ ਮੈਂ ਜਿਹੜਾ ਕਿ ਦੌੜ ਗਿਆ ਮੈਨੂੰ ਇੰਨਾ ਜ਼ਿਆਦਾ ਦੌੜਨਾ ਆਉਂਦਾ ਸੀ ਮੈਂ ਦੌੜਦਾ ਦੌੜਦਾ ਭੱਜ ਗਿਆ ਅਤੇ ਉਹਨਾਂ ਬੇਚਾਰਿਆਂ ਦੇ ਇੰਨੀਆਂ ਪਈਆਂ ਇੰਨੀਆਂ ਪਈਆਂ ਜਿਵੇਂ ਸਾਡੇ ਘਰ ਤਾਂ ਵੀ ਇੰਨੇ ਉਲਾਂਭੇ ਆਏ ਦੁਕਾਨਦਾਰ ਦੇ ਵੀ ਆਏ ਅਤੇ ਉਹ ਜਿਹੜੇ ਬੱਚੇ ਮੈਂ ਨਾਲ ਲਾਏ ਸੀ ਉਹਨਾਂ ਦੇ ਪੇਰੈਂਟਸ ਵੀ ਆਏ ਤਾਂ ਮੇਰੇ ਨਾਲ ਕੀ ਇੰਨੀ ਭੈੜੀ ਹੋਈ ਮੈਂ ਦੱਸ ਨਹੀਂ ਸਕਦਾ ਕਿ ਸਾਡੇ ਘਰਦਿਆਂ ਦਾ ਜਿਹੜਾ ਗੁੱਸਾ ਹੈਗਾ ਮੇਰੇ ਉੱਪਰ ਇੰਨਾ ਜ਼ਿਆਦਾ ਫਟਿਆ ਮੈਂ ਦੱਸ ਨਹੀਂ ਸਕਦਾ ਇਹ ਬਹੁਤ ਹੀ ਹਾਸੇ ਵਾਲੀ ਗੱਲ ਹੈ ਜਦੋਂ ਮੈਂ ਹੁਣ ਵੀ ਯਾਦ ਕਰਦਾਂ ਤਾਂ ਮੇਰਾ ਖੂਬ ਹਾਸਾ ਆਉਂਦਾ ਐਗਾ ਇਸ ਤੋਂ ਇਲਾਵਾ ਮੈਂ ਇੱਕ ਹੋਰ ਸ਼ਰਾਰਤ ਕੀਤੀ ਇੱਕ ਨਾ ਆਹ ਨਾਲੀਆਂ ਪੁੱਟਣ ਵਾਲੇ ਕਸ਼ਮੀਰੀਏ ਜਿਹੇ ਆਉਂਦੇ ਹੁੰਦੇ ਸੀ ਵੀਹ ਕੁ ਸਾਲ ਪਹਿਲਾਂ ਉਦੋਂ ਉਦੋਂ ਦੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਕਿ ਮੈਂ ਨਾ ਇੱਕ ਆਪਦੇ ਮੂੰਹ ਵਗੈਰਾ ਲਪੇਟ ਕੇ ਨਾ ਜਿਮੀ ਛੋਟਾ ਜਿਹਾ ਅਤੇ ਹੋਰ ਜਿਹੀ ਪਾ ਕੇ ਮੈਂ ਸਾਡੇ ਗੁਆਂਢੀਆਂ ਦੇ ਘਰ ਗਿਆ ਮੈਂ ਬਾਹਰ ਕਰਨ ਲੱਗਾ ਬੀ ਬੀ ਰੋਟੀ ਦੇ ਦਿਉ ਬੀ ਬੀ ਰੋਟੀ ਦੇ ਦਿਉ ਉਹ ਕਹਿੰਦੀਆਂ ਰੋਟੀ ਤਾਂ ਬਣੀ ਨਹੀਂ ਕਿਤੋਂ ਰੋਡੇ ਲੱਗੇ ਹੋਏ ਰੋਜ਼ ਹੀ ਆ ਜਾਂਦੇ ਆ ਮੈਂ ਕਿਹਾ ਨਹੀਂ ਬੀ ਬੀ ਰੋਟੀ ਦੇ ਦਿਉ ਚਲੋ ਉਹਨਾਂ ਦੀ ਇੱਕ ਲੜਕੀ ਕਹਿੰਦੀ ਬੀਬੀ ਇਹ ਕਹਿੰਦੀ ਮੰਮੀ ਵੀ ਰੋਟੀ ਦੇ ਦਿੰਦੇ ਚਲ ਇੱਕ ਪਈ ਆ ਆਪਾਂ ਇਹੀ ਦੇ ਦਿੰਦੇ ਹਾਂ ਇਹਨੂੰ ਆਪਾਂ ਹੋਰ ਪ ਬਣਾਵਾਂਗੇ ਤੜਕੇ ਵਾਲੀ ਦੇ ਦਿੰਦੇ ਹਾਂ ਅਤੇ ਜਦੋਂ ਕੁੜੀ ਲੜਕੀ ਸਵੇਰ ਵਾਲੀ ਰੋਟੀ ਮੈਨੂੰ ਦੇਣ ਆਈ ਤਾਂ ਉਹਨੂੰ ਮੇਰੀ ਪਛਾਣ ਨਹੀਂ ਆਈ ਤਾਂ ਇਹਦਾ ਮਤਲਬ ਵੀ ਉਹਨੇ ਮੈਨੂੰ ਰੋਟੀ ਐਂ ਸੁੱਟ ਕੇ ਭੱਜ ਗਈ ਮੈਂ ਉਹਦੇ ਮਗਰ ਹੀ ਤੁਰ ਪਿਆ ਉਹਨੂੰ ਦੱਸਣ ਜਾ ਰਿਹਾ ਸੀ ਵੀ ਇਹ ਤਾਂ ਮੈਂ ਸੀ ਵੀ ਮੈਂ ਉਹ ਥੋੜ੍ਹਾ ਇਹ ਤਾਂ ਮੈਂ ਹੈਗਾ ਅਤੇ ਪਰ ਉਹ ਡਰ ਗਈ ਉਹਨੇ ਆਖਿਆ ਜਿਹੜਾ ਕਸ਼ਮੀਰੀਆ ਅਤੇ ਮੇਰੇ ਮਗਰ ਆ ਗਿਆ ਅਤੇ ਉਹਨੇ ਉੱਚੀ ਉੱਚੀ ਇੰਨੀਆਂ ਜ਼ਿਆਦਾ ਚੀਕਾਂ ਮਾਰੀਆਂ ਵੀ ਮੀਨਜ਼ ਉਦੋਂ ਉਹਨੂੰ ਅਟੈਕ ਹੋ ਜਾਣਾ ਸੀਗਾ ਫਿਰ ਉਹਨੂੰ ਮੈਂ ਲਾਹ ਕੇ ਦੱਸਿਆ ਤਾਂ ਫਿਰ ਮੇਰੀ ਸ਼ਰਾਰਤ ਦਾ ਕੋਈ ਅੰਤ ਨਹੀਂ ਸੀਗਾ ਜਿਹੜੀ ਮੈਂ ਕੀਤੀ ਸੀ ਜਿਹੜਾ ਕੋਈ ਆਵੇ ਦੋ ਮੇਰੇ ਇੱਧਰੋਂ ਧਰ ਦੇ ਦੋ ਮੇਰੇ ਇੱਧਰੋਂ ਧਰ ਦੇ ਅਤੇ ਉਹ ਇੰਨੀਆਂ ਸ਼ਰਾਰਤਾਂ ਸੀ ਮੇਰੀਆਂ ਦੌੜਨ ਵਾਲੀਆਂ